ਯੋਗਾ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਚੀਜ਼ ਹੈ ਇਸ ਦੇ ਕਰਨ ਨਾਲ ਸਾਡੀ ਸਿਹਤ ਦੇ ਬਹੁਤ ਵਧੀਆ ਰਹਿੰਦੀ ਹੈ ਸਰੀਰਿਕ ਰੋਗ ਠੀਕ ਹੁੰਦੇ ਨੇ ਸਰੀਰ ਸਵਸਥ ਰਹਿੰਦਾ ਹੈ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਆਉਂਦੀ ਇਸ ਕਰਕੇ ਯੋਗਾ ਬਹੁਤ ਚੰਗੀ ਸਮਝੀ ਜਾਂਦੀ ਹੈ ਸਾਡੇ ਘਰ ਦੇ ਵਿੱਚ ਯੋਗਾ ਦਾ ਬਹੁਤ ਅਭਿਆਸ ਹੁੰਦਾ ਸੀ ਬੜੇ ਕਈ ਤਰੀਕਿਆਂ ਦੇ ਨਾਲ ਅਸੀਂ ਯੋਗਾ ਕਰਦੇ ਆਏ ਹਾਂ ਅਸੀਂ ਦੇਖਦੇ ਦੇਖਦੇ ਆਪਦੇ ਸਰੀਰ ਨੂੰ ਤੰਦਰੁਸਤ ਕਰ ਲਿਆ ਕਰਨ ਦੀ ਬਜਾਏ ਸਾਨੂੰ ਦੇਖਣ ਨਾਲ ਹੀ ਬੜਾ ਫਰਕ ਪੈ ਗਿਆ ਹੈ ਇਸ ਕਰਕੇ ਇਸ ਕਰਕੇ ਯੋਗਾ ਦਾ ਮਹੱਤਵ ਬਹੁਤ ਬਹੁਤ ਹੀ ਵਧੀਆ ਹੈ ਸਾਨੂੰ ਯੋਗਾ ਤੋਂ ਕਈ ਲਾਭ ਵੀ ਹੁੰਦੇ ਨੇ ਸਾਡੇ ਸਰੀਰ ਦੇ ਵਿੱਚ ਕਈ ਬਿਮਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਡਾਕਟਰ ਵੀ ਨਹੀਂ ਠੀਕ ਕਰ ਸਕਦੇ ਅਤੇ ਇਹ ਯੋਗਾ ਕਰਨ ਦੇ ਨਾਲ ਉਹ ਅਭਿਆਸ ਹੁੰਦਾ ਹੈ ਉਹਦੇ ਨਾਲ ਸਾਡੇ ਜਿਹੜੇ ਸਰੀਰ ਦੇ ਰੋਗ ਏ ਉਹ ਬੜਾ ਠੀਕ ਹੋ ਜਾਂਦੇ ਅਸੀਂ ਸਵਸਥ ਹੋ ਜਾਂਦੇ ਸਾਨੂੰ ਯੋਗਾ ਦੇ ਕਈ ਲਾਭ ਹਨ ਹਾਂਜੀ